ਮੇਰਾ ਜੱਦੀ ਸ਼ਹਿਰ ਯਾਨੀ ਕਿ ਅੰਮ੍ਰਿਤਸਰ ਜਿਹੜਾ ਕਿ ਪੰਜਾਬ 'ਚ ਹੈ ਬਹੁਤ ਖਾਣੇ ਦੀ ਜਿਹੜੀ ਕਿ ਗੁਰੂ ਦੀ ਨਗਰੀ ਹੈ ਉਹ ਖਾਣੇ ਦੇ ਵਾਸਤੇ ਬਹੁਤ ਬਹੁਤ ਹੀ ਮਸ਼ਹੂਰ ਹੈ ਅਤੇ ਮੇਰਾ ਇੱਥੋਂ ਸਭ ਤੋਂ ਮਨ ਪਸੰਦੀਦਾ ਚੀਜ਼ ਹੈ ਕੁਲਚਾ ਅਤੇ ਛੋਲੇ ਅੰਮ੍ਰਿਤਸਰ ਦੇ ਕੁਲਚੇ ਛੋਲੇ ਮੰਨੇ ਗਏ ਨੇ ਲੋਕ ਇੱਥੇ ਦੂਰੋਂ ਦੂਰੋਂ ਤੋਂ ਖਾਣ ਆਉਂਦੇ ਨੇ ਕੁਲਚੇ ਛੋਲੇ ਅਤੇ ਇੱਥੋਂ ਦੇ ਗੁਲਾਬ ਜਾਮੁਣ ਵੀ ਮੈਨੂੰ ਇਹ ਦੋਨੋਂ ਚੀਜ਼ਾਂ ਬਹੁਤ ਹੀ ਜ਼ਿਆਦਾ ਪਸੰਦ ਨੇ ਕੁਲਚੇ ਛੋਲੇ ਸਾਡੇ ਇੱਥੇ ਬਹੁਤ ਦੋ ਚਾਰ ਦੁਕਾਨਾਂ ਨੇ ਜਿੱਥੋਂ ਬਹੁਤ ਵਧੀਆ ਮਿਲਦੇ ਨੇ ਇੱਕ ਹੈ ਨੱਥੂ ਭਲਵਾਨ ਦਾ ਕੁਲਚਾ ਉਹ ਮੈਂ ਬਚਪਨ ਤੋਂ ਖਾਂਦੀ ਆ ਰਹੀ ਹਾਂ ਉਹਦਾ ਜਿਹੜਾ ਸਵਾਦ ਹੈ ਮਤਲਬ ਮੂੰਹ 'ਚ ਜਿੱਦਾਂ ਹੀ ਪਾਓ ਅਤੇ ਘੁੱਲਦਾ ਹੀ ਜਾਂਦਾ ਹੈ ਰਸ ਇੰਨਾਂ ਆਉਂਦਾ ਹੈ ਕਿ ਬਸ ਸਾਡਾ ਦਿਲ ਕਰਦਾ ਕਿ ਇਸ ਤੋਂ ਵਧੀਆ ਕੋਈ ਚੀਜ਼ ਹੀ ਨਹੀਂ ਹੈ ਅਤੇ ਜਿਹੜੇ ਗੁਲਾਬ ਜਾਮੁਨ ਹੈ ਉਹ ਇੱਥੇ ਇੱਕ ਸ਼ਰਮੇ ਦੀ ਦੁਕਾਨ ਹੈ ਉਹ ਉੱਥੋਂ ਮੈਨੂੰ ਬਹੁਤ ਜ਼ਿਆਦਾ ਹੀ ਪਸੰਦ ਹੈ ਉਹ ਵੀ ਮੂੰਹ 'ਚ ਗਰਮ ਗਰਮ ਜਦੋਂ ਪਾਈ ਦੇ ਹੈ ਅਤੇ ਜ਼ਿੰਦਗੀ ਦਾ ਮਜ਼ਾ ਆ ਜਾਂਦਾ ਉਹਨੂੰ ਖਾ ਕੇ ਅਤੇ ਮੈਨੂੰ ਆਪਣੇ ਜ਼ੱਦੀ ਸ਼ਹਿਰ ਯਾਨੀ ਕਿ ਅੰਬਰਸਰ ਦੀ ਦੋ ਚੀਜ਼ਾਂ ਬਹੁਤ ਹੀ ਪਸੰਦ ਨੇ ਕੁਲਚਾ ਛੋਲੇ ਅਤੇ ਦੂਸਰਾ ਗੁਲਾਬ ਜਾਮੁਨ ਮੈਨੂੰ ਐਂ ਲੱਗਦਾ ਹੈ ਕਿ ਇੱਥੋਂ ਸਵਾਦ ਕੁਛ ਨਹੀਂ ਹੁੰਦਾ ਨਾ ਇਹਦੇ ਵਰਗਾ ਕੋਈ ਜਿਹੜਾ ਸਵਾਦ ਹੈ ਉਹ ਮੈਨੂੰ ਅੰਮ੍ਰਿਤਸਰ ਤੋਂ ਬਾਹਰ ਕਦੇ ਮਿਲੇਗਾ ਜਿਹੜਾ ਵੀ ਅੰਮ੍ਰਿਤਸਰ ਆਏ ਅਸੀਂ ਉਹਨਾਂ ਨੂੰ ਜ਼ਰੂਰ ਖਵਾਨੇ ਹਾਂ ਅੰਮ੍ਰਿਤਸਰ ਲੋਕ ਜਿਹੜਾ ਵੀ ਆਉਂਦਾ ਹੈ ਉਹ ਬਿਨਾਂ ਕੁਲਚੇ ਛੋਲੇ ਤੋਂ ਆਪਾਂ ਖਵਾਏ ਬਿਨਾਂ ਭੇਜ ਹੀ ਨਹੀਂ ਸਕਦੇ ਉਹਨੂੰ